ਇਨਸਾਨ ਦਾ ਕੋਈ ਵੀ ਕੰਮ ਚੁਣੌਤੀਆਂ ਤੋਂ ਬਿਨਾਂ ਪੂਰਾ ਨਹੀਂ ਹੁੰਦਾ ਹਰ ਕਦਮ 'ਚ ਹਰ ਕੰਮ 'ਚ ਚੁਣੌਤੀ ਦਾ ਸਾਹਮਣਾ ਤਾਂ ਇੱਕ ਇਨਸਾਨ ਨੂੰ ਕਰਨਾ ਹੀ ਪੈਂਦਾ ਹੈ ਇੱਦਾਂ ਦੀ ਹੀ ਇੱਕ ਚੁਣੌਤੀ ਦਾ ਸਾਹਮਣਾ ਮੈਨੂੰ ਮੇਰੇ ਕੰਮ 'ਤੇ ਮੈਨੂੰ ਮੇਰੀ ਜੋਬ 'ਤੇ ਕਰਨਾ ਪਿਆ ਸੀ ਮੇਰੇ ਬੋਸ ਨੇ ਇੱਕ ਮੈਨੂੰ ਪ੍ਰੋਜੈਕਟ ਦਿੱਤਾ ਸੀ ਜੋ ਕਿ ਕਾਫ਼ੀ ਹੀ ਜ਼ਿਆਦਾ ਔਖਾ ਸੀਗਾ ਮੇਰੀ ਕੰਮ ਕਰਨ ਦੀ ਸ਼ਮਤਾ ਕਾਫ਼ੀ ਜ਼ਿਆਦਾ ਸੀਗੀ ਮੇਰੀ ਪਰਫੋਰਮੈਂਸ ਮੇਰੇ ਕੰਮ 'ਤੇ ਕਾਫ਼ੀ ਅੱਛੀ ਹੈ ਇਸ ਕਰਕੇ ਬੋਸ ਨੇ ਮੈਨੂੰ ਉਹ ਪ੍ਰੋਜੈਕਟ ਦਿੱਤਾ ਸੀ ਕਿ ਉਹਨਾਂ ਨੂੰ ਮੇਰੇ 'ਤੇ ਭਰੋਸਾ ਸੀ ਕਿ ਇਹ ਪ੍ਰੋਜੈਕਟ ਮੈਂ ਬਹੁਤ ਚੰਗੀ ਤਰ੍ਹਾਂ ਪੂਰਾ ਕਰੂੰਗੀ ਪਰ ਮੇਰੇ ਸਾਰੇ ਸਹਿ ਕਰਮਚਾਰੀਆਂ ਨੇ ਬੋਸ ਨੂੰ ਕਿਹਾ ਕਿ ਤੁਹਾਨੂੰ ਇਹ ਪ੍ਰੋਜੈਕਟ ਇੱਕ ਔਰਤ ਨੂੰ ਨਹੀਂ ਸੀ ਦੇਣਾ ਚਾਹੀਦਾ ਕਿਉਂਕਿ ਔਰਤ ਦੀ ਉੰਨੀ ਸ਼ਮਤਾ ਨਹੀਂ ਹੁੰਦੀ ਜਿੰਨੀ ਇੱਕ ਮਰਦ ਦੀ ਹੁੰਦੀ ਆ ਇੱਕ ਮਰਦ ਜਿੰਨੀ ਅੱਛੀ ਤਰਾਂ ਇੱਕ ਪ੍ਰੋਜੈਕਟ ਨੂੰ ਪੂਰਾ ਕਰ ਸਕਦਾ ਹੈ ਇੱਕ ਔਰਤ ਨਹੀਂ ਕਰ ਸਕਦੀ ਇਹ ਉਹਨਾਂ ਦੀ ਇੱਕ ਥਿੰਕਿੰਗ ਸੀਗੀ ਔਰ ਮੈਂ ਚਾਹੁੰਦੀ ਹੀ ਕਿ ਸਭ ਨੂੰ ਇਹ ਪਤਾ ਚੱਲੇ ਕਿ ਔਰਤ ਅਤੇ ਮਰਦ ਵਿੱਚ ਕੋਈ ਫ਼ਰਕ ਨਹੀਂ ਹੁੰਦਾ ਅਗਰ ਉਹ ਕੰਮ ਮ ਇੱਕ ਕੰਮ ਅਗਰ ਮਰਦ ਅੱਛੀ ਤਰ੍ਹਾਂ ਕਰ ਸਕਦਾ ਹੈ ਤਾਂ ਉਹ ਕੰਮ ਇੱਕ ਔਰਤ ਵੀ ਉੰਨੀ ਹੀ ਅੱਛੀ ਤਰ੍ਹਾਂ ਕਰ ਸਕਦੀ ਹੈ ਮੇਰੇ ਬੋਸ ਨੇ ਮੇਰੇ 'ਤੇ ਭਰੋਸਾ ਦਿਖਾਇਆ ਹੈ ਅਤੇ ਉਹ ਭਰੋਸਾ ਮੈਂ ਤੋੜਨਾ ਹੀ ਨਹੀਂ ਸੀ ਚਾਹੁੰਦੀ ਇੱਕ ਟਾਈਮ 'ਤੇ ਮੇਰੇ ਮਾਂ ਬਾਪ ਨੇ ਵੀ ਮੈਨੂੰ ਇਹ ਹੀ ਚੀਜ਼ ਬੋਲ ਦਿੱਤੀ ਸੀ ਕਿ ਜਿਹੜਾ ਪ੍ਰੋਜੈਕਟ ਸੀ ਉਹ ਤੈਨੂੰ ਨਹੀਂ ਸੀ ਲੈਣਾ ਚਾਹੀਦਾ ਉਹ ਤੂੰ ਉਸ ਆਦਮੀ ਨੂੰ ਦੇ ਦਿੰਦੀ ਕਿ ਉਹ ਉਹ ਇੱਕ ਮਰਦ ਹੀ ਕਰ ਲੈਂਦਾ ਤਾਂ ਚੰਗਾ ਹੁੰਦਾ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਪ੍ਰੋਜੈਕਟ ਸ਼ਾਇਦ ਕਿਤੇ ਨਾ ਕਿਤੇ ਮੇਰੇ ਤੋਂ ਨਾ ਪੂਰਾ ਹੋਵੇ ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਜਿੱਦਾਂ ਜੋਬ 'ਤੇ ਸਾਰੇ ਹੀ ਸਹਿ ਕਰਮਚਾਰੀ ਇਹ ਕਹਿ ਰਹੇ ਸੀ ਕਿ ਕਿ ਇਹ ਪ੍ਰੋਜੈਕਟ ਤਾਂ ਤੁਹਾਨੂੰ ਇੱਕ ਮਰਦ ਨੂੰ ਦੇਣਾ ਚਾਹੀਦਾ ਸੀ ਅਤੇ ਉਹਨਾਂ ਨੇ ਕਿਹਾ ਕਿ ਕਿਉਂਕਿ ਆਪਣੇ ਕੰਮ ਦੀ ਕਿਸੇ ਨਾ ਕੋਈ ਦੁਸ਼ਮਣੀ ਮੋੜ ਰਿ ਲੈ ਰਹੀ ਹਾਂ ਉਹ ਕੰਮ ਅਗਰ ਤੇਰੇ ਤੋਂ ਪੂਰਾ ਨਾ ਹੋਇਆ ਤੇ ਸਾਰੇ ਤੈਨੂੰ ਤਾਨੇ ਮਾਰਨਗੇ ਮੇਨੇ ਮੇਣੇ ਦੇਣਗੇ ਕਿ ਤੂੰ ਅਸੀਂ ਤਾਂ ਪਹਿਲੇ ਕਿਹਾ ਹੀ ਤੈਥੋਂ ਨਹੀਂ ਹੋਣਾ ਨਹੀਂ ਹੋਣਾ ਤੇ ਬਸ ਉਹ ਇੱਕ ਚੀਜ਼ ਸੀਗੀ ਕਿ ਹਾਂ ਲੋਕ ਮੈਨੂੰ ਕਹਿ ਰਹੇ ਆ ਲੋਕ ਮੈਨੂੰ ਥੱਲੇ ਖਿੱਚਣ ਦੀ ਕੋਸ਼ਿਸ਼ ਕਰਨ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ ਪ੍ਰੋਜੈਕਟ ਇੱਦਾਂ ਦਾ ਹੈਗਾ ਕਿ ਮੈਂ ਇੱਕ ਸੇਲ 'ਚ ਡਿਪਾਰਟਮੈਂਟ 'ਚ ਕੰਮ ਕਰਦੀ ਹਾਂ ਆਹ ਮਹੀਨੇ ਦੀ ਜਿਹੜੀ ਜਿਹੜਾ ਸੇਲਜ਼ ਟਾਰਗੇਟ ਹੁੰਦਾ ਵਾ ਉਹ ਸੱਤਰ ਤੋਂ ਅੱਸੀ ਪਰਸੈਂਟ ਹੁੰਦਾ ਹੈ ਅਤੇ ਮੇਰੇ ਬੋਸ ਨੇ ਕਿਹਾ ਹੈ ਕਿ ਮੈਨੂੰ ਉਹ ਜਿਹੜਾ ਸੀਗਾ ਟਾਰਗੇਟ ਆ ਉਹ ਅੱਸੀ ਤੋਂ ਨੱਬੇ ਪਰਸੈਂਟ ਤੱਕ ਲੈ ਕੇ ਜਾਣਾ ਹੈ ਜੋ ਕਿ ਇੱਕ ਬਹੁਤ ਹੀ ਮੁਸ਼ਕਿਲ ਚੀਜ਼ ਸੀ ਕਿਉਂਕਿ ਅੱਸ ਸੱਤਰ ਤੋਂ ਅੱਸੀ ਪਰਸੈਂਟ ਜਿਹੜਾ ਇੱਕ ਮਹੀਨਾ ਹੁੰਦਾ ਵਾ ਉਹਨੂੰ ਮੈਂ ਅੱਸੀ ਤੋਂ ਨੱਬੇ ਤੱਕ ਕਰਨਾ ਸੀਗਾ ਔਰ ਇਹ ਹੋਇਆ ਕਿ ਜਿੱਦਾਂ ਲੋਕੀਆ ਲੋਕਾਂ ਨੇ ਮੈਨੂੰ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਮੇਰੇ 'ਚ ਉੰਨੀ ਹੀ ਜ਼ਿਆਦਾ ਮੋਟੀਵੇਸ਼ਨ ਆਈ ਕਿ ਮੈਂ ਸਾਰੀ ਦੁਨੀਆਂ ਨੂੰ ਸਾਬਿਤ ਕਰਾਂ ਕਿ ਇੱਕ ਮਰਦ ਅਤੇ ਔਰਤ ਦੇ ਵਿੱਚ ਫ਼ਰਕ ਨਹੀਂ ਹੁੰਦਾ ਬਾਕੀ ਮੈਨੂੰ ਮੇਰੀ ਸ਼ਮਤਾ 'ਤੇ ਵੀ ਪੂਰਾ ਭਰੋਸਾ ਸੀ ਕਿ ਮੈਂ ਉਹ ਪ੍ਰੋਜੈਕਟ ਕਰ ਸਰਦੀ ਹਾਂ ਔਰ ਇੱਕ ਆਦਮੀ ਤੋਂ ਤਾਂ ਬਹੁਤ ਹੀ ਅੱਛੀ ਤਰ੍ਹਾਂ ਕਰ ਸਕਦੀ ਹਾਂ ਫਿਰ ਉਹ ਪ੍ਰੋਜੈਕਟ ਮੈਂ ਕੀਤਾ ਔਰ ਮੇਰਾ ਸੇਲਸ ਟਾਰਗੇਟ ਵੀ ਅੱਸੀ ਤੋਂ ਨੱਬੇ ਪਰਸੈਂਟ ਨਹੀਂ ਸੀ ਈਵਨ ਨੱਬੇ ਪਰਸੈਂਟ ਤੋਂ ਵੀ ਜ਼ਿਆਦਾ ਸੀਗਾ ਔਰ ਸਾਰੀ ਦੁਨੀਆਂ ਨੂੰ ਈਵਨ ਮੈਂ ਆਪਣੇ ਮਾਂ ਬਾਪ ਨੂੰ ਵੀ ਦਿਖਾ ਦਿੱਤਾ ਕਿ ਮੈਂ ਮੇਰੇ 'ਚ ਉਹ ਸ਼ਮਤਾ ਹੈਗੀ ਆ ਔਰ ਇੱਕ ਔਰਤ ਅਤੇ ਮਰਦ ਬਰਾਬਰ ਹੁੰਦੇ ਨੇ ਜਿਹੜਾ ਕੰਮ ਮਰਦ ਅੱਛੀ ਤਰ੍ਹਾਂ ਕਰ ਸਕਦਾ ਹੈ ਇੱਕ ਔਰਤ ਵੀ ਉੰਨੀ ਹੀ ਅੱਛੀ ਤਰ੍ਹਾਂ ਉਹ ਚੀਜ਼ ਕਰ ਸਕਦੀ ਹੈ